ਪਟਿਆਲਾ ਬੜਾ ਹੀ ਸੋਹਣਾ ਇੱਕ ਜ਼ਿਲ੍ਹਾ ਹੈ ਜਿਹਦੇ ਵਿੱਚ ਮਤਲਬ ਲੋਕਾਂ ਦੀ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਵਾਸਤੇ ਉਹਨਾਂ ਨੂੰ ਬਹੁਤ ਵਧੀਆ ਐਜੂਕੇਸ਼ਨ ਸਿੱਖਿਆ ਦੇਣ ਵਾਸਤੇ ਗਰੀਬੀ ਨੂੰ ਘਟਾਉਣ ਵਾਸਤੇ ਇੱਦਾਂ ਦੇ ਅਲੱਗ ਅਲੱਗ ਲੋਕ ਭਲਾਈ ਪ੍ਰੋਗਰਾਮ ਆਉਂਦੇ ਰਹਿੰਦੇ ਨੇ ਠੀਕ ਹੈ ਤਾਂ ਜਿੱਥੇ ਕਿ ਮੈਨੂੰ ਜਿੱਥੇ ਤੱਕ ਮੈਨੂੰ ਪਤਾ ਹੈ ਪਟਿਆਲੇ ਦੇ ਵਿੱਚ ਇੱਕ ਰਜਿੰਦਰਾ ਹੋਸਪਿਟਲ ਹੈ ਜਿੱਥੇ ਕਿ ਸਰਕਾਰ ਟਾਈਮ ਦੇ ਨਾਲ ਨਾਲ ਇੱਕ ਬਹੁਤ ਵਧੀਆ ਫੈਸਿਲਿਟੀਜ ਉੱਥੇ ਅੱਪਡੇਟ ਜਿੰਨੀਆਂ ਵੀ ਟੈਕਨੋਲਜੀ ਹੈ ਜਾਂ ਉੱਥੋਂ ਦਾ ਸਟਾਫ ਬੜਾ ਵਧੀਆ ਹੈ ਮਤਲਬ ਸਟਾਫ ਪੂਰੇ ਕੀਤੇ ਜਾਂਦੇ ਆ ਹੈ ਨਾ ਤਾਂ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਾਰਾ ਕੁਛ ਮੇਨਟੇਨ ਕੀਤਾ ਜਾਂਦਾ ਹੋਸਪਿਟਲਸ ਬਹੁਤ ਵਧੀਆ ਅਲੱਗ ਅਲੱਗ ਦੂਰ ਦੂਰ ਥਾਂਵਾਂ ਤੋਂ ਲੋਕ ਰਾਜਿੰਦਰਾ ਹੋਸਪਿਟਲ ਨੂੰ ਵਿਜ਼ਿਟ ਕਰਨ ਆਉਂਦੇ ਨੇ ਸੇਮ ਮੈਡੀਕਲ ਕੋਲੇਜ ਹੈ ਜਿੱਥੇ ਐਜੂਕੇਸ਼ਨ ਦੇ ਲਈ ਹੀ ਬੜੇ ਹੀ ਕੰਪੀਟੀਸ਼ਨਸ ਦੇ ਨਾਲ ਇਗਜ਼ਾਮ ਲਏ ਜਾਂਦੇ ਹਨ ਬੱਚੇ ਉੱਥੇ ਮ ਮਤਲਬ ਦਿਨ ਰਾਤ ਮਿਹਨਤ ਕਰਕੇ ਆਪਣਾ ਇੱਕ ਸੀਟ ਲੈਂਦੇ ਨੇ ਤਾਂ ਉੱਥੋਂ ਮੈਡੀਕਲ ਕੋਲੇਜ ਵੀ ਬਹੁਤ ਗੁੱਡ ਹੈ ਪਟਿਆਲੇ ਦੇ ਵਿੱਚ ਇਸ ਤੋਂ ਬਿਨਾਂ ਡਰੱਗ ਦੇ ਨਾਲ ਰਿਲੇਟਡਸ ਅਵੇਅਰਨੈੱਸ ਕੈਂਪ ਲੱਗਦੇ ਰਹਿੰਦੇ ਨੇ ਅਲੱਗ ਅਲੱਗ ਕੋਲਜਸ ਜਿਵੇਂ ਕਿ ਖਾਲਸਾ ਕੋਲੇਜ ਪਟਿਆਲਾ ਦੇ ਵਿੱਚ ਹੀ ਡਰੱਗਸ ਨੂੰ ਲੈ ਕੇ ਇੱਕ ਬੱਡੀਜ਼ ਗਰੁੱਪ ਦੇ ਨਾਲ ਅਲੱਗ ਅਲੱਗ ਪ੍ਰੋਜੈਕਟ ਆਉਂਦੇ ਨੇ ਗੋਂਰਮੈਂਟ ਵੱਲੋਂ ਜਿੱਥੇ ਕਿ ਜਿਹੜੇ ਮਤਲਬ ਇਸ ਸਬਜੈਕਟ ਦੇ ਨਾਲ ਰਿਲੇਟਡਸ ਐਕਸਪਰਟਸ ਨੇ ਉਹਨਾਂ ਤੋਂ ਲੈਕਚਰ ਕਰਵਾਏ ਜਾਂਦੇ ਨੇ ਉੱਥੋਂ ਦੇ ਸਟੂਡੈਂਟਸ ਜਾਂ ਅਦਰ ਔਰਡੀਅੰਸ ਜਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਵੀ ਇੱਕ ਜਾਗਰੂਕਤਾ ਨਸ਼ਿਆਂ ਨੂੰ ਲੈ ਕੇ ਦਿੱਤੀ ਜਾਂਦੀ ਹੈ ਤਾਂ ਉੱਥੇ ਬੱਡੀਸ ਗਰੁੱਪ ਦੇ ਅੰਡਰ ਜਿਹੜੇ ਖਾਲਸਾ ਕੋਲੇਜ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪ੍ਰੋਫੈਸਰਸ ਵੀ ਨੇ ਉਹ ਵੀ ਲੈਕਚਰਸ ਦਿੰਦੇ ਨੇ ਇਸੇ ਤਰੀਕੇ ਨਾਲ ਜਿਵੇਂ ਕਿ ਇੱਕ ਇਨਵਾਇਰਮੈਂਟ ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਵੀ ਕਈ ਰੈਲੀਆਸ ਕੀਤੀਆਂ ਜਾਂਦੀਆਂ ਪਟਿਆਲੇ ਦੇ ਵਿੱਚ ਕੋਲੇਜਸ ਵੱਲੋਂ ਵੀ ਜਾਂ ਫਿਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਅਤੇ ਉਹ ਕੋਲੇਜਸ ਦੇ ਵਿੱਚ ਟੀਚਰਸ ਦੀ ਡਿਊਟੀਜ ਲਗਾਉਂਦੇ ਨੇ ਕਿ ਉਹ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਾਣ ਜਿਵੇਂ ਕਿ ਸਟਬਲ ਬਰਨਿੰਗ ਨੂੰ ਲੈ ਕੇ ਹੀ ਕਾਫੀ ਸੀ ਕਿ ਇੱਕ ਸਮਾਜ ਦੇ ਵਿੱਚ ਹਰ ਇੱਕ ਨੂੰ ਬਹੁਤ ਵਧੀਆ ਸਹੂਲਤਾ ਦੇਣਾ ਉਹਨਾਂ ਦੀ ਸਿਹਤ ਨੂੰ ਲੈ ਕੇ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਗੰਦੀ ਹਵਾ ਨਾ ਮਿਲੇ ਤਾਂ ਐਂਨ ਸਟਬਲ ਬਰਨਿੰਗ ਨੂੰ ਲੈ ਕੇ ਵੀ ਇੱਕ ਚੇਤਨਾ ਰੈਲੀ ਕੱਢੀ ਜਾਂਦੀ ਹੈ ਅਤੇ ਉੱਥੇ ਜਿਵੇਂ ਕਿ ਤਬਲਾਨ ਪਿੰਡ ਦੇ ਵਿੱਚ ਜਾ ਕੇ ਜਾਂ ਧਾਮੂ ਮਾਜਰਾ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਉਹ ਕਿੰਨੇ ਨੁਕਸਾਨ ਨੇ ਇਸ ਸਟਬਲ ਬਰਨਿੰਗ ਦੇ ਕਿਸਾਨਾਂ ਨੂੰ ਅਵੇਅਰ ਕੀਤਾ ਜਾਂਦਾ ਤਾਂ ਕਿ ਉੱਥੋਂ ਦਾ ਜਿਹੜਾ ਹਵਾ ਪਾਣੀ ਆ ਉਹ ਸਾਫ਼ ਰਹਿ ਸਕੇ ਇਸ ਤੋਂ ਬਿਨਾਂ ਹੋਰ ਵੀ ਜਿਵੇਂ ਕਿ ਇੱਕ ਜਿਹੜੀਆਂ ਗਰਲਸ ਨੇ ਜਾਂ ਲੇਡੀਜ਼ ਨੇ ਉਹਨਾਂ ਉਹਨਾਂ ਨੂੰ ਵੀ ਮਤਲਬ ਅਵੇਅਰ ਕੀਤਾ ਜਾਂਦਾ ਅਲੱਗ ਅਲੱਗ ਸਕੀਮਾਂ ਨੂੰ ਲੈ ਕੇ ਠੀਕ ਹੈ ਹਰ ਇੱਕ ਕੋਲੇਜ ਦੇ ਵਿੱਚ ਸਕੂਲ ਦੇ ਵਿੱਚ ਜਿਹੜੇ ਐਂਟੀ ਸ਼ੈਕਸ਼ੂਅਲ ਹਰਾਸ਼ਮੈਂਟ ਹੈ ਜਾਂ ਫਿਰ ਐਂਟੀ ਰੈਗਿੰਗ ਹੈ ਇੱਦਾਂ ਦੇ ਸੈੱਲ ਬਣਾਏ ਜਾਂਦੇ ਨੇ ਤਾਂ ਕਿ ਲੋਕ ਜਾਂ ਜਾਂ ਬੱਚੇ ਆ ਕਿਸੇ ਵੀ ਪ੍ਰੋਬਲਮ ਜੇ ਉਹਨਾਂ ਨੂੰ ਸਮੱਸਿਆ ਆ ਰਹੀ ਆ ਤਾਂ ਉੱਥੋਂ ਦੇ ਹੈੱਡ ਦੇ ਨਾਲ ਜਾਂ ਡੀਨ ਦੇ ਨਾਲ ਕੰਸਰਨ ਕਰਕੇ ਆਪਣੀ ਪ੍ਰੋਬਲਮ ਨੂੰ ਸੋਲਵ ਕਰੇ ਇਸ ਤਰੀਕੇ ਦੇ ਨਾਲ ਹਰ ਇੱਕ ਕੋਲੇਜ 'ਚ ਸਕੂਲ 'ਚ ਜਾਂ ਫਿਰ ਲੋਕਲ ਲੈਵਲ ਦੇ ਉੱਪਰ ਵੀ ਹਰ ਇੱਕ ਦਾ ਧਿਆਨ ਰੱਖਿਆ ਜਾਂਦਾ ਅਤੇ ਪਟਿਆਲੇ ਸ਼ਹਿਰ ਦੇ ਵਿੱਚ ਜਾਂ ਪੰਜਾਬੀ ਯੂਨੀਵਰਸਿਟੀ ਬੜੀ ਮੇਨ ਹੈ ਤਾਂ ਉੱਥੋਂ ਵੀ ਕਈ ਪ੍ਰੋਜੈਕਟ ਜਾਂ ਸਕੀਮਾਂ ਐਵੇਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਪੂਰੇ ਹਰ ਇੱਕ ਨੂੰ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਸਾਰਿਆਂ ਨੂੰ ਅਵੇਅਰ ਕਰਨ ਦੇ ਵਿੱਚ ਅਤੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਭਲਾਈ ਅਤੇ ਕਲਿਆਣ ਦੇ ਲਈ ਸਭ ਪ੍ਰੋਜੈਕਟ ਵਗੈਰਾ ਦਿੰਦੇ ਰਹਿੰਦੇ ਹੈ ਥੈਂਕ ਯੂ